ਮੇਰਾ ਨਾਮ ਬਸੰਤ ਕੁਮਾਰ ਹੈ ਮੈਂ ਕੁਝ ਟਾਈਮ ਪਹਿਲਾਂ ਐਮਾਜ਼ੋਨ ਆਪ ਤੋਂ ਜੈਕਟ ਔਰਡਰ ਕਰਵਾਈ ਸੀ ਮੇਰੇ ਦ ਫਰੈਂਡ ਦਾ ਵਿਆਹ ਸੀਗਾ ਉਸ ਲਈ ਅਤੇ ਮੈਂ ਉਹਦੀ ਔਨਲਾਈਨ ਡਿਲਿਵਰੀ ਵੀ ਪਹਿਲੇ ਕਰ ਦਿੱਤੀ ਸੀ ਪਰ ਉਹ ਜਦ ਉਹਨਾਂ ਨੇ ਮਤਲਬ ਜੈਕਟ ਤਾਂ ਟਾਇਮਲੀ ਭੇ ਭੇਜ ਦਿੱਤੀ ਪਰ ਜਿਹੜਾ ਉਹਦਾ ਜਦ ਮੈਂ ਉਹ ਪਾ ਕੇ ਦੇਖੀ ਇੱਕ ਤਾਂ ਮੈਨੂੰ ਉਹਦਾ ਕਲਰ ਦ ਜੋ ਉਹਨਾਂ ਨੇ ਮਤਲਬ ਸ਼ੋ ਕਰਵਾਇਆ ਸੀ ਮਤਲਬ ਫੋਨ 'ਚ ਉਹ ਨਹੀਂ ਮਤਲਬ ਪ੍ਰੋਪਰ ਨਹੀਂ ਸੀਗਾ ਅਤੇ ਜਦ ਮੈਂ ਜੈਕਟ ਉਹ ਪਾ ਕੇ ਦੇਖੀ ਤਾਂ ਉਹਦੇ ਅੰਦਰੋਂ ਮਤਲਬ ਜੇਬਾਂ ਵੀ ਫਟੀਆਂ ਹੋਈਆਂ ਸੀ ਮਤਲਬ ਕੰਡੀਸ਼ਨ ਠੀਕ ਨਹੀਂ ਸੀ ਅਤੇ ਪਾ ਕੇ ਵੈਸੇ ਵੀ ਮੈਨੂੰ ਲੂਜ਼ ਲੱਗ ਰਹੀ ਸੀ ਇਸ ਕਰਕੇ ਉਹਦੇ ਨਾਲ ਮੈਨੂੰ ਬੜੀ ਪ੍ਰੋਬਲਮ ਹੋਈ ਕਿਉਂਕਿ ਮੇਰੇ ਫਰੈ ਦੋਸਤ ਦਾ ਵਿਆਹ ਸੀਗਾ ਅਤੇ ਮੈਨੂੰ ਉਹ ਮਤਲਬ ਜੈਕਟ ਰਿਟਰਨ ਕਰਨੀ ਪਈ ਅਤੇ ਮੈਨੂੰ ਵਿੱਚ ਉਹਦੇ ਆਪਣੇ ਬਾਜ਼ਾਰ ਜਾ ਕੇ ਅਲੱਗ ਤੋਂ ਆਪਣੇ ਫਰੈਂਡ ਦੇ ਵਿਆਹ ਲਈ ਫਿਰ ਜੈਕਟ ਲੈਣੀ ਪੈ ਗਈ ਜਿਸ ਲਈ ਮੈਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੋ ਮੇਰੀ ਤੁਹਾਡੇ ਨਾਲ ਇਹੀ ਰਿਕੁਐਸਟ ਹੈ ਕਿ ਤੁਸੀਂ ਆਪਣੀ ਸਪਲਾਈ ਮਤਲਬ ਜੋ ਤੁਸੀਂ ਮਤਲਬ ਭੇਜਦੇ ਹੋ ਮਤਲਬ ਐਕੂਰੇਟ ਭੇਜਿਆ ਕਰੋ ਜੋ ਤੁਸੀਂ ਮਤਲਬ ਦਿਖਾਉਂਦੇ ਹੋ ਉਹ ਚੀਜ਼ ਪ੍ਰੋਪਰ ਨਹੀਂ ਹੁੰਦੀ ਹੈ ਉਸ ਤੋਂ ਅਲੱਗ ਹੀ ਹੁੰਦੀ ਹੈ ਅਤੇ ਕੱਪੜਾ ਵੀ ਉੱਦਾਂ ਦਾ ਨਹੀਂ ਹੁੰਦਾ ਜੋ ਤੁਸੀਂ ਫੋਨ 'ਚ ਦਿਖਾਇਆ ਹੁੰਦਾ ਆਪਣੀ ਐਪ 'ਚ ਜਿੱਦਾਂ ਵੀ ਹੈ ਸੋ ਮੇਰੀ ਇਹੀ ਰਿਕੁਐਸਟ ਹੈ ਕਿ ਅੱਗੇ ਤੋਂ ਆਪਣੀਆਂ ਚੀਜ਼ਾਂ 'ਚ ਸੁਧਾਰ ਕਰੋ ਤਾਂ ਕਿ ਅੱਗੇ ਤੋਂ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ